ਜਿਸ ਕੱਪੜੇ ਨੂੰ ਮੈਂ ਬਣਾਉਣਾ ਚਾਹੁੰਦੀ ਹੋਵਾਂ ਤਾਂ ਉਹਦਾ ਡਿਜ਼ਾਇਨ ਵਗੈਰਾ ਵੇਖਣ ਲਈ ਪਹਿਲਾਂ ਤਾਂ ਮੈਂ ਵੇਖਦੀ ਹਾਂ ਵੀ ਮੇਰੇ ਕੋਲ ਸੇਮ ਡਿਜ਼ਾਇਨ ਦਾ ਉਹੋ ਜਿਹਾ ਪਹਿਲਾਂ ਤਾਂ ਨਹੀਂ ਬਹੁਤ ਜ਼ਿਆਦਾ ਕਲੈਕਸ਼ਨ ਹੈਗੀ ਜਿਵੇਂ ਕਿ ਅੱਜ ਕੱਲ੍ਹ ਸਰਦੀਆਂ ਵਾਲੇ ਉਹ ਚਲਦੇ ਆ ਚੈੱਕ ਵਾਲੇ ਸੂਟ ਅਤੇ ਦੋ ਮੇਰੇ ਕੋਲ ਪਹਿਲਾਂ ਹੀ ਹੈਗੇ ਆ ਅਤੇ ਫਿਰ ਹੋਰ ਜ਼ਿਆਦਾ ਸੇਮ ਡਿਜ਼ਾਇਨ ਇਕੱਠਾ ਨਹੀਂ ਕਰਨਾ ਅਤੇ ਪੈਟਰਨ ਜਿਹੜਾ ਵਾ ਉਹ ਮੈਂ ਕੋਸ਼ਿਸ਼ ਕਰਦੀ ਹੁੰਦੀ ਜਾਂ ਤਾਂ ਕੋਈ ਜੋਮੈਟ੍ਰਿਕ ਪੈਟਰਨ ਹੋਵੇ ਉਹ ਤਾਂ ਫਲਾਵਰ ਵਾਲੇ ਜਿਹੜੇ ਆ ਨਾ ਉਹ ਫਿਰ ਕੰਮ 'ਤੇ ਪਾਏ ਹੋਏ ਇੰਨੇ ਚੰਗੇ ਨਹੀਂ ਲੱਗਦੇ ਉਹ ਕੰਮ 'ਤੇ ਜਾਂ ਤਾਂ ਫਿਰ ਪਲੇਨ ਸੂਟ ਚੰਗੇ ਲੱਗਦੇ ਆ ਉਹ ਪਲੇਨ ਸੂਟ ਬਣਾਈਏ ਅਤੇ ਉਹਨਾਂ 'ਤੇ ਲੈਸ ਵਰਕ ਵਗੈਰਾ ਕਰਨਾ ਪੈਂਦਾ ਅਤੇ ਉਹ ਜਿਹੜਾ ਥੋੜ੍ਹਾ ਜਿਹਾ ਫਿਰ ਮਹਿੰਗਾ ਪੈ ਜਾਂਦਾ ਲੈਸਾਂ ਬਹੁਤ ਮਹਿੰਗੀਆਂ ਅਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਉਹ ਡਿਜ਼ਾਈਨ ਚੁਣਾਂ ਥੋੜ੍ਹਾ ਜੁਮੈਟ੍ਰਿਕ ਜਿਹਾ ਹੋਵੇ ਫਲਾਵਰ ਵਾਲਾ ਨਾ ਹੀ ਹੋਵੇ ਕੰਮ 'ਤੇ ਪਾਉਣਾ ਹੁੰਦਾ ਵਾ ਅਤੇ ਉਹ ਵੀ ਹੋਵੇ ਕਿ ਪਹਿਲਾਂ ਵੀ ਮੇਰੇ ਕੋਲ ਉਹੋ ਜਿਹੀ ਕਲੈਕਸ਼ਨ ਨਾ ਹੋਵੇ ਇਸ ਤਰ੍ਹਾਂ ਦਾ ਕੱਪੜਾ ਮੈਂ ਚੁਣਦੀ ਹਾਂ ਮੌਸਮ ਦੇ ਅਨੁਸਾਰ ਵੀ ਕੱਪੜੇ ਨੂੰ ਵੇਖਣਾ ਪੈਂਦਾ ਵਾ ਸਰਦੀਆਂ ਵਾਲਾ ਆ ਗਰਮੀਆਂ ਵਾਲਾ ਵਾ ਜਾਂ ਫਿਰ ਕਈ ਵਾਰੀ ਜਿਹੜੇ ਆ ਕੋਟਸ ਵੂਲ ਵਗੈਰਾ ਦੇ ਕੱਪੜੇ ਚੂਜ ਕਰ ਲਈਦੇ ਜਿਹੜੇ ਥੋੜ੍ਹੇ ਜਿਹੇ ਜਿਹੜਾ ਵਾ ਘੱਟ ਸਰਦੀ ਦੇ ਵਿੱਚ ਵੀ ਪੈ ਜਾਂਦੇ ਨੇ ਜਾਂ ਕਈ ਵਾਰੀ ਉਹ ਜਿਹਾ ਕੱਪੜਾ ਲਈਦਾ ਜਿਹੜਾ ਗਰਮੀ ਸਰਦੀ ਦੋਹਾਂ 'ਚ ਪੈ ਜਾਵੇ ਬਹੁਤ ਜ਼ਿਆਦਾ ਗਰਮੀ ਵਿੱਚ ਤਾਂ ਜਿਹੜਾ ਆ ਉਹ ਬਿਲਕੁਲ ਮੈਨੂੰ ਸੂਤੀ ਕੱਪੜਾ ਹੀ ਸੂਟ ਕਰਦਾ ਆ ਗਰਮੀ ਦੇ ਵਿੱਚ ਤਾਂ ਨਾ ਤਾਂ ਕੋਈ ਮਿਕਸ ਕੱਪੜਾ ਅਤੇ ਨਾ ਕੋਈ ਸਿੰਥੈਟਿਕ ਕੱਪੜਾ ਪਾਇਆ ਜਾਂਦਾ ਹਾਂ ਸਰਦੀਆਂ ਦੇ ਵਿੱਚ ਹਰ ਤਰ੍ਹਾਂ ਦਾ ਕੱਪੜਾ ਜਿਹੜਾ ਉਹ ਮੈਂ ਪਾ ਲੈਂਦੀ ਹਾਂ ਪਰ ਗਰਮੀਆਂ ਦੇ ਵਿੱਚ ਚੁਣਨ ਲਈ ਸਿਰਫ ਲਾਈਟ ਕਲਰ ਅਤੇ ਸਿਰਫ ਸੂਤਰੀ ਕੱਪੜੇ ਚੁਣੇ ਜਾਂਦੇ ਆ ਸਰਦੀਆਂ ਦੇ ਵਿੱਚ ਤਾਂ ਵੂਲਨ ਵੀ ਲੈ ਲਈਦੇ ਆ ਅਤੇ ਕੋਟਨ ਵੀ ਲੈ ਲਈਦੀ ਆ ਖਾਦੀ ਸਿਲਕ ਵੀ ਲੈ ਲਈਦੀ ਆ ਸਿਲਕ ਵੀ ਲੈ ਲਈ ਸਰਦੀਆਂ ਦੇ ਵਿੱਚ ਹਰ ਤਰ੍ਹਾਂ ਦਾ ਕੱਪੜਾ ਜਿਹੜਾ ਉਹ ਲੈ ਲਿਆ ਜਾਂਦਾ ਮੈਂ ਕੋਈ ਬ੍ਰੈਂਡ ਜਾਂ ਔਨਲਾਈਨ ਵਾਲੇ ਕੱਪੜੇ ਨਹੀਂ ਲੈਂਦੀ ਮੈਨੂੰ ਤਾਂ ਜਾ ਕੇ ਸਵਾਦ ਆਉਂਦਾ ਵਾ ਵੀ ਵੇਖ ਕੇ ਚੀਜ਼ ਜਿਹੜੀ ਆਪ ਲੈ ਲਵੋ